ਆਪਣੇ ਸਮਾਜ ਵਿੱਚ ਖੇਡਾਂ ਖੇਡਣ ਦੇ ਮਹੱਤਵ ਨੂੰ ਲੈ ਕੇ ਪੇਂਡੂ ਲੋਕਾਂ ਦੀ ਬਹੁਤ ਹੀ ਸੁਚਾਰੂ ਰਾਏ ਹੈ ਪੇਂਡੂ ਲੋਕਾਂ ਦਾ ਖੇਡਾਂ ਖੇਡਣ ਦੇ ਮਹੱਤਵ ਬਾਰੇ ਇਹ ਰਾਏ ਹੈ ਕਿ ਖੇਡਾਂ ਜੀਵਨ ਦਾ ਮੂਲ ਆਧਾਰ ਹਨ ਅਤੇ ਇਹ ਮਨੁੱਖ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਮਦਦ ਕਰਦੀਆਂ ਹਨ ਖੇਡਾਂ ਖੇਡਣ ਨਾਲ ਮਨ ਨੂੰ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਖੇਡਾਂ ਖੇਡਣ ਨਾਲ ਮਨੁੱਖ ਮਾਨਸਿਕ ਤੌਰ 'ਤੇ ਵਿਕਾਸ ਕਰਦਾ ਹੈ ਅਤੇ ਕਾਫੀ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚ ਸਕਦਾ ਹੈ ਜਿਵੇਂ ਕਿ ਤਨਾਓ ਤੋਂ ਵੀ ਮੁਕਤੀ ਪਾ ਸਕਦਾ ਹੈ ਅਤੇ ਖੇਡਾਂ ਖੇਡਣ ਨਾਲ ਕਾਫੀ ਤਰ੍ਹਾਂ ਦੀ ਸਾਂਝ ਵੀ ਪੈਦਾ ਹੁੰਦੀ ਹੈ ਅਤੇ ਉਹ ਆਪਣੇ ਆਲੇ ਦੁਆਲੇ ਵਿੱਚ ਵਧੀਆ ਰਿਸ਼ਤੇ ਬਣਾ ਸਕਦਾ ਹੈ ਅਤੇ ਜਾਤ ਪਾਤ ਨੂੰ ਖ਼ਤਮ ਕਰ ਸਕਦਾ ਹੈ